ਮੈਂ ਇੱਕ ਛੋਟੀ ਜਿਹੀ ਕਿੱਟੀ ਪਾਰਟੀ ਰੱਖੀ ਸੀ ਜਿਸ ਵਿੱਚ ਮੈਂ ਆਪਣੀਆਂ ਸਹੇਲੀਆਂ ਪੰਦਰਾਂ ਵੀਹ ਸਹੇਲੀਆਂ ਬੁਲਾਈਆਂ ਉਹਨਾਂ ਨੂੰ ਬੁਲਾਉਣ ਤੋਂ ਪਹਿਲਾਂ ਮੈਂ ਆਪਣਾ ਸਬਜ਼ੀ ਅਤੇ ਰੋਟੀ ਪਾਣੀ ਦਾ ਸਾਰਾ ਕੰਮ ਕਰ ਲਿਆ ਸੀ ਤਾਂ ਜੋ ਮੈਂ ਉਹਨਾਂ ਨਾਲ ਵਿਹਲੇ ਟਾਈਮ ਵਿੱਚ ਵਾਧੂ ਟਾਈਮ 'ਚ ਗੱਲਾਂ ਮਾਰ ਸਕਾਂ ਜਿਸ ਨਾਲ ਕਿ ਮੈਂ ਸਬਜ਼ੀਆਂ ਦੇ ਵਿੱਚ ਮੈਂ ਤਿੰਨ ਤੋਂ ਚਾਰ ਸਬਜ਼ੀਆਂ ਵੀ ਰੱਖੀਆਂ ਜਿਸ ਨਾਲ ਕਿ ਮੇਰੀਆਂ ਸਹੇਲੀਆਂ ਖਾਣ ਵੇਲੇ ਖੁਸ਼ ਹੋ ਜਾਣ

ਸ਼ਾਹੀ ਪਨੀਰ ਤਿਆਰ ਕਰਦੇ ਟਾਈਮ ਮੈਂ ਉਹਦੇ ਵਿੱਚ ਅਲੱਗ ਤੋਂ ਅਲੱਗ ਫਲੇਵਰ ਪਾਏ ਕਿ ਖਾਣ ਟਾਈਮ ਮੇਰੇ ਫਰੈਂਡਸ ਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਉਸ ਤੋਂ ਬਾਅਦ ਮੈਂ ਮਟਰ ਪਨੀਰ ਲਈ ਵੀ ਮਸਾਲਾ ਤਿਆਰ ਕੀਤਾ ਜਿੰਨਾਂ ਮੈਂ ਮਸਾਲਾ ਸ਼ਾਹੀ ਪਨੀਰ ਵਾਸਤੇ ਤਿਆਰ ਕੀਤਾ ਸੀ ਉਨਾਂ ਹੀ ਮੈਂ ਮਟਰ ਪਨੀਰ ਵਾਸਤੇ ਮਸਾਲਾ ਤਿਆਰ ਕੀਤਾ ਜਦੋਂ ਮਸਾਲਾ ਤਿਆਰ ਕਰ ਰਹੀ ਸੀ ਤਾਂ ਉਸ ਦੇ ਵਿੱਚ ਮੈਨੂੰ ਅਲੱਗ ਤੋਂ ਮਟਰ ਅਤੇ ਆਲੂਆਂ ਦੀ ਲੋੜ ਪਈ ਸੀ ਜੋ ਕਿ ਮੈਂ ਪਹਿਲਾਂ ਹੀ ਕੱਟ ਲਏ ਸੀ ਕਿ ਮੇਰਾ ਟਾਈਮ ਥੋੜ੍ਹਾ ਬੱਚ ਸਕੇ ਪ ਮਟਰ ਪਨੀਰ ਬਣਾਉਣ ਵੇਲੇ ਵੀ ਮੈਨੂੰ ਪਨੀਰ ਦੇ ਵਿੱਚ ਪਹਿਲਾਂ ਮੈਂ ਪਿਆਜ ਟਮਾਟਰ ਸਾਰਿਆਂ ਨੂੰ ਸਬਜ਼ੀ ਮਸਾਲੇ ਨੂੰ ਗ੍ਰੈਂਡ ਦੇ ਵਿੱਚ ਮਿਕਸਰ ਕਰਕੇ ਉਸ ਦਾ ਤੜਕਾ ਲਗਾਇਆ ਤੜਕਾ ਲਗਾਉਣ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਪਨੀਰ ਨੂੰ ਆਲੂ ਅਤੇ ਪਨੀਰ ਨੂੰ ਸੀਟੀ ਲਵਾਈ ਤਾਂ ਕਿ ਜੋ ਪਨੀਰ ਆਲੂ ਅਤੇ ਪਨੀਰ ਦਾ ਮਿਕਚਰ ਹੈ ਉਹ ਉਹਦੇ ਵਿੱਚ ਮਸਾਲੇ ਮਸਾਲਾ ਉਸਦੇ ਵਿੱਚ ਰੱਚ ਜਾਵੇ ਉਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਮੈਂ ਉਹਨਾਂ ਨੂੰ ਮਟਰਾਂ ਨੂੰ ਵੀ ਪਾ ਕੇ ਉਸ ਨੂੰ ਬਣਾਇਆ ਜਦੋਂ ਬਣਾ ਰਹੀ ਸੀ ਤਾਂ ਮੈਨੂੰ ਇਸਦਾ ਉਸਦੀ ਫਰੈਗਰੈਂਸਟੀ ਇੰਨੀ ਵਧੀਆ ਸਮੈਲ ਆ ਰਹੀ ਸੀ ਕਿ ਸਬਜ਼ੀ ਮੇਰੀ ਬਹੁਤ ਜ਼ਿਆਦਾ ਵਧੀਆ ਬਣੀ ਹੈ ਜਦੋਂ ਬਣਾ ਰਹੀ ਸੀ ਤਾਂ ਪਨੀਰ ਦੇ ਵਿੱਚ ਮੈਂ ਅਲੱਗ ਤੋਂ ਇੱਕ ਘਰ ਦਾ ਬਣਿਆ ਤਿਆਰ ਕੀਤਾ ਮਸਾਲਾ ਪਾਇਆ ਜੋ ਕਿ ਸਬਜ਼ੀ ਨੂੰ ਬਹੁਤ ਹੀ ਜ਼ਿਆਦਾ ਵਧੀਆ ਅਤੇ ਸਵਾਦਿਸ਼ਟ ਬਣਾ ਰਿਹਾ ਸੀ ਅਤੇ ਉਸ ਤੋਂ ਬਾਅਦ ਫਿਰ ਮੈਂ ਦਾਲ ਨੂੰ ਵੀ ਐਵੇਂ ਤੜਕਾ ਲਾਇਆ ਦਾਲ ਪਹਿਲਾਂ ਹੀ ਮੈਂ ਉਬਾਲ ਉਬੋਲ ਕੇ ਰੱਖ ਦਿੱਤੀ ਸੀ ਤਾਂ ਜੋ ਮੈਨੂੰ ਬਣਾਉਣ ਟਾਈਮ ਜਲਦੀ ਬਣਾ ਸਕਾਂ ਉਸ ਲਈ ਮੈਂ ਤੜਕਾ ਤਿਆਰ ਕੀਤਾ ਹੋਇਆ ਸੀ ਅਤੇ ਮੈਂ ਉਹ ਦਾਲ ਪਹਿਲਾਂ ਹੀ ਉਬਾਲ ਕੇ ਰੱਖ ਲਈ ਸੀ ਜਦੋਂ ਦਾਲ ਉਬਾਲੀ ਸੀ ਤਾਂ ਉਸ ਤੋਂ ਬਾਅਦ ਉਹਨੂੰ ਤੜਕਾ ਲਗਾਉਣ ਵੇਲੇ ਮੈਨੂੰ ਜ਼ਿਆਦਾ ਦਿੱਕਤ ਨਹੀਂ ਆਈ ਦਿੱਕਤ ਰੋਟੀ ਨੇ

ਜਦੋਂ ਮੈਂ ਖਾਣਾ ਬਣਾਇਆ ਅਤੇ ਇਹ ਮੈਂ ਸਾਰਾ ਖਾਣਾ ਖੜ੍ਹ ਕੇ ਬਣਾਇਆ ਅਤੇ ਜਿੰਨਾਂ ਮੈਂ ਖਾਣਾ ਬਣਾਇਆ ਸੀ ਸਾਰਾ ਮੇਰਾ ਘੱਟੋ ਘੱਟ ਘੰਟੇ ਦੇ ਵਿੱਚ ਸਾਰਾ ਖਤਮ ਹੋ ਗਿਆ ਸੀ ਅਤੇ ਮੈਂ ਆਪਣੇ ਟਾਈਮ ਦੀ ਬਹੁਤ ਜ਼ਿਆਦਾ ਬੱਚਤ ਕਿਉਂਕਿ ਜਦੋਂ ਮੈਂ ਖਾਣਾ ਬਣਾਉਂਦੀ ਸੀ ਤਾਂ ਇੱਕ ਦੇ ਨਾਲ ਨਾਲ ਮੈਂ ਦੂਸਰੀ ਸਬਜ਼ੀ ਵੀ ਤਿਆਰ ਕਰੀ ਜਾ ਰਹੀ ਸੀ

ਦੂਸਰੀਆਂ ਸਬਜ਼ੀਆਂ ਨੂੰ ਵੀ ਤਿਆਰ ਕਰਕੇ ਪਹਿਲਾਂ ਹੀ ਰੱਖਣਾ ਚਾਹੀਦਾ ਤਾਂ ਜੋ ਕਿ ਮੈਂ ਫਿਰ ਮੈਂ ਆਪਣੀ ਸਹੇਲੀ ਨਾਲ ਵੱਧ ਤੋਂ ਵੱਧ ਗੱਲਾਂ ਮਾਰੀਆਂ ਅਤੇ ਮੈਂ ਆਪਣੇ ਟਾਈਮ ਨੂੰ ਵੀ ਬਹੁਤ ਬਚਾਇਆ ਜੋ ਕੰਮ ਮੈਂ ਉਹਨਾਂ ਦੇ ਆਉਣ ਤੋਂ ਬਾਅਦ ਕਰਨਾ ਸੀ ਉਹ ਮੈਂ ਪਹਿਲਾਂ ਹੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਾਰਾ ਕੰਮ ਨਿਬੇੜ ਦਿੱਤਾ ਸੀ ਤਾਂ ਜੋ ਉਹਨਾਂ ਨੇ ਨਾਲ ਮੈਂ ਚੰਗੀ ਤਰ੍ਹਾਂ ਬੈਠ ਕੇ ਗੱਲਾਂ ਮਾਰ ਸਕਾਂ ਜਾਂ ਕੋਈ ਵੀ ਗੱਲ ਕਰ ਸਕਾਂ ਜੇਕਰ ਮੈਂ ਉਹਨਾਂ ਦੇ ਪਹਿਲਾਂ ਕੰਮ ਨਾ ਕਰਦੀ ਤਾਂ ਉਹਨਾਂ ਨੇ ਨਾਲ ਉਹਨਾਂ ਕੋਈ ਮਜ਼ਾ ਨਹੀਂ ਸੀ ਕਿਉਂਕਿ ਮੈ ਆਪਣਾ ਕੰਮ ਕਰਨਾ ਸੀ ਰੋਟੀ ਪਾਣੀ ਤਿਆਰ ਕਰਨੀ ਅਤੇ ਉਹਨਾਂ ਨੂੰ ਲੱਗਣਾ ਸੀ ਵੀ ਹਾਂ ਅਸੀਂ ਤਾਂ ਫਾਲਤੂ 'ਚ ਬਸ ਆਈਆਂ ਹੀ ਏ ਇਹ ਸਾਡੇ ਨਾਲ ਗੱਲਾਂ ਨਹੀਂ ਮਾਰ ਇਸ ਕਰਕੇ ਮੈਂ ਆਪਣੇ ਕੰਮ ਦੀ ਬੱਚਤ ਕੀਤੀ ਅਤੇ ਟਾਈਮ ਵੀ ਵਧਾਇਆ ਅਤੇ ਉਸ ਤੋਂ ਬਾਅਦ ਮੇਰੀਆਂ ਜਿੰਨੀਆਂ ਸਬਜ਼ੀਆਂ ਬਣਾਈਆਂ ਸੀ ਚਾਰੋਂ ਦੇ ਚਾਰੋਂ ਸਬਜ਼ੀਆਂ ਬਹੁਤ ਜ਼ਿਆਦਾ ਵਧੀਆ ਬਣੀਆਂ ਸੀ ਜਿਸ ਨੂੰ ਖਾ ਕੇ ਉਹ ਬਹੁਤ ਜ਼ਿਆਦਾ ਖੁਸ਼ ਸਨ ਅਤੇ ਕਹਿ ਰਹੀਆਂ ਸੀ ਕਿ ਅਗਲੀ ਵਾਰ ਵੀ ਅਸੀਂ ਤੇਰੇ ਹੀ ਘਰ ਆ ਕੇ ਤੇਰੇ ਹੱਥੋਂ ਇਹੀ ਸਬਜ਼ੀਆਂ ਦੁਬਾਰਾ ਖਾਵਾਂਗੇ ਤਾਂ ਜੋ ਸਾਨੂੰ ਇਹ ਇਹ ਸਬਜ਼ੀਆਂ ਦੀ ਰੈਸਪੀ ਤੂੰ ਸਾਨੂੰ ਵੀ ਦੱਸੀ ਤਾਂ ਜੋ ਅਸੀਂ ਆਪਣੇ ਘਰਦਿਆਂ ਨੂੰ ਖਿਲਾ ਕੇ ਖੁਸ਼ ਕਰ ਸਕੀਏ ਕਿਉਂਕਿ ਉਹ ਸਬਜ਼ੀਆਂ ਬਿਹਤਰੀਨ ਅਤੇ ਲਾਜਵਾਬ ਸਬਜ਼ੀਆਂ ਬਣੀਆਂ ਸਨ